ਹੈਲੋ ਬਸ ਵਧੀਆ ਬੜੇ ਦਿਨਾਂ ਬਾਅਦ ਯਾਦ ਕੀਤਾ ਬਸ ਵਧੀਆ ਯਾਰ ਬੀਟੈਕ ਕਰਕੇ ਵਿਹਲੇ ਫਿਰਦੇ ਹਾਂ ਮੈਂ ਹਾਂਜੀ ਹਾਂਜੀ ਦੱਸੋ

ਬਹੁਤ ਵਧੀਆ ਆਈਡੀਆ ਬਹੁਤ ਵਧੀਆ ਬਹੁਤ ਵਧੀਆ ਆ

ਹਾਂ ਹਾਂ ਮੈਨੂੰ ਤੇਰਾ ਆਈਡੀਆ ਵਧੀਆ ਲੱਗਿਆ ਮੈਂ ਆਵਾਂਗੀ ਬਾਕੀ ਸਭ ਵਧੀਆ

ਹੂੰ ਹੂੰ

ਠੀਕ ਆ ਸ਼ਾਮੀ ਮਿਲਦੇ ਆ ਠੀਕ ਆ ਥੈਂਕ ਯੂ ਸ਼ਾਮੀ ਮਿਲਦੇ ਹਾਂ